ਇੱਕ ਤੈਰਾਕੀ ਬੰਦੇ ਦਾ ਸਿਹਤ ਪੱਖੋਂ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੈਰਨ ਸਮੇਂ ਉਸਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ ਜੇਕਰ ਉਹ ਬੰਦਾ ਤੰਦਰੁਸਤ ਨਹੀਂ ਹੈ ਮੂ ਜਾ ਸਭ ਤੋਂ ਜ਼ਿਆਦਾ ਇੱਕ ਤੈਰਾਕੀ ਬੰਦੇ ਨੂੰ ਸਾਹ ਨਾਲ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ ਜਿਸ ਕਾਰਨ ਉਸਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਉਹ ਪੂਰੀ ਤਰ੍ਹਾਂ ਤੈਰ ਨਹੀਂ ਪਾਉਂਦਾ ਸੋ ਇਸ ਲਈ ਕਿਹਾ ਜਾਂਦਾ ਹੈ ਕਿ ਇੱਕ ਤੈਰਾਕੀ ਬੰਦੇ ਨੂੰ ਸਿਹਤ ਪੱਖੀ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਸ ਬੰਦੇ ਦੀ ਸਿਹਤ ਠੀਕ ਨਹੀਂ ਹੋਵੇਗੀ ਅਤੇ ਉਸਨੂੰ ਸਾਹ ਲੈਣ ਵਿੱਚ ਸਮੱਸਿਆ ਆਵੇਗੀ ਤਾਂ ਉਹ ਚੰਗੀ ਤਰ੍ਹਾਂ ਤੈਰ ਨਹੀਂ ਪਾਵੇਗਾ ਤਾਂ ਉਸਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਉਹ ਆਪਣਾ ਸੰਤੁਲਨ ਖੋ ਸਕਦਾ ਹੈ ਅਤੇ ਪਾਣੀ ਵਿੱਚ ਡੁੱਬ ਵੀ ਸਕਦਾ ਹੈ